ਹੈਲੋ ਹਾਂ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਗੁਰਿੰਦਰ ਦੀ ਮੰਮੀ ਬੋਲ ਰਹੀ ਹਾਂ ਜੀ ਮੇਰਾ ਬੇਟਾ ਨਾ ਤੁਹਾਡੇ ਸਕੂਲ 'ਚ ਪੜ੍ਹਦਾ ਹੈ ਜੀ ਪੰਜਵੀਂ ਕਲਾਸ 'ਚ ਸਤ ਪੰਜਵੀਂ ਕਲਾਸ 'ਚ ਹੈ ਜੀ ਭੈਣ ਜੀ ਅੱ ਹਾਂਜੀ ਹਾਂ ਇੱਕ ਬੇਨਤੀ ਕਰਨੀ ਸੀ ਭੈਣ ਜੀ ਉਹ ਨਾ ਅੱਜ ਛੁੱਟੀ ਚਾਹੀਦੀ ਸੀ ਬੇਟੇ ਨੂੰ ਥੋੜ੍ਹੀ ਜਿਹੀ ਅਸੀਂ ਕਿਸੇ ਫੰਕਸ਼ਨ 'ਚ ਜਾਣਾ ਭੈਣ ਜੀ ਜ਼ਰੂਰੀ ਹੈ ਜੀ ਪਰ ਭੈਣ ਜੀ ਸਾਡੀ ਮਜਬੂਰੀ ਹੈ ਦੇਖੋ ਜੀ ਅਸੀਂ ਕਿਤੇ ਬਹੁਤ ਹੀ ਅ ਜ਼ਰੂਰੀ ਜ਼ਰੂਰੀ ਸੰਬੰਧ ਵਿੱਚ ਜਾਣਾ ਜੀ ਇਹ ਥੋੜ੍ਹਾ ਜਿਹਾ ਨਾ ਸਾਡੇ ਹੈ ਵੀ ਸੋਹਰਿਆਂ ਵਾਲੇ ਪਾਸੇ ਜ਼ਰੂਰੀ ਹੈ ਕੰਮ ਹੈ ਨਾ ਉਹ ਵੀ ਥੋੜ੍ਹਾ ਜਿੱਦ ਕਰਦੇ ਹੈ ਜੀ ਭੂਆ ਭਤੀਜੇ ਦਾ ਪਿਆਰ ਇੰਨਾ ਭੈਣ ਜੀ ਹੈ ਨਾ ਇਹਦੇ ਕਰਕੇ ਹੈ ਜੀ ਬੇਨਤੀ ਓ ਹੈ ਜੀ ਮੇਰਾ ਮੁੰਡਾ ਹੈ ਤਾਂ ਪੜ੍ਹਨ ਨੂੰ ਵੀ ਹੁਸ਼ਿਆਰ ਹੈ ਜੀ ਕਵਰ ਕਰ ਲੂਗਾ ਜੀ ਉਹ ਸਾਰੀ ਪੜ੍ਹਈ ਐਂ ਤਾਂ ਜੀ ਜੋ ਅੱਜ ਵੀ ਕਰਾਉਂਗੇ ਤੁਸੀਂ

ਹਾਂ ਜੀ ਭੈਣ ਜੀ ਉਹ ਮੈਂ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਬਸ ਤੁਸੀਂ ਆਹੀ ਤਾਂ ਬਹੁਤ ਬਹੁਤ ਧੰਨਵਾਦ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਛੁੱਟੀ ਸਾਨੂੰ ਮਿਲ ਗਈ ਧੰਨਵਾਦ ਹੈ ਜੀ ਓ ਹਾਂਜੀ ਜੀ ਜੀ ਹਾਂਜੀ ਹਾਂਜੀ ਹਾਂ ਕੋਈ ਨਾ ਭੈਣ ਜੀ ਆਪਣੇ ਹੱਥ ਹੋਵੇ ਫਿਰ ਤਾਂ ਅਸੀਂ ਕੰਮ ਵੀ ਕਰ ਲਈਏ ਹੈ ਨਾ ਜੀ ਹੁਣ ਬੇਗਾਨੇ ਹੱਥਾਂ ਦਾ ਕੰਮ ਹੈ ਜੀ ਬਜ਼ੁਰਗਾਂ ਦਾ ਵੀ ਮਾਣ ਸਤਿਕਾਰ ਕਰਨਾ ਪੈਂਦਾ ਜੀ ਮੰਨਣਾ ਪੈਂਦਾ ਠੀਕ ਹੈ ਜੀ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਨਾ ਜੀ ਧੰਨਵਾਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ